ਆਵਾਜਾਈ ਦੇ ਬਹੁਤ ਸਾਰੇ ਸਾਧਨ ਅਸੀਂ ਦੇਖਦੇ ਹਾਂ ਜਿਨ੍ਹਾਂ ਵਿੱਚ ਬੱਸ ਕਾਰ ਟਰੱਕ ਆਟੋ ਸਮੁੰਦਰੀ ਜਹਾਜ਼ ਹਵਾਈ ਜਹਾਜ਼ ਰੇਲ ਗੱਡੀ ਆਦਿ ਹਨ ਇਹਨਾਂ ਵਿੱਚੋਂ ਕੁਝ ਸਾਧਨ ਅਜਿਹੇ ਹਨ ਜੋ ਲੋਕਾਂ ਨੂੰ ਇੱਧਰ ਉੱਧਰ ਤੋਂ ਲਿਜਾਂਦੇ ਆ ਬਲਕਿ ਜ਼ਰੂਰਤ ਵਾਲੀ ਕਈ ਚੀਜ਼ਾਂ ਨੂੰ ਵੀ ਇੱਧਰ ਉੱਧਰ ਪਹੁੰਚਾਉਂਦੇ ਆ ਜਹਾਜ਼ ਅਤੇ ਹਵਾਈ ਜਹਾਜ਼ ਦੇ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਅਤੇ ਚੀਜ਼ਾਂ ਨੂੰ ਇੱਧਰ ਉੱਧਰ ਪਹੁੰਚਾਉਂਦੇ ਹਨ ਪਰ ਰੇਲ ਗੱਡੀ ਅਜਿਹਾ ਸਾਧਨ ਹੈ ਜੋ ਅੰਤਰ ਦੇਸੀ ਆਵਾਜਾਈ ਦਾ ਸਾਧਨ ਹੈ ਇਸ ਦਾ ਸਫਰ ਸਸਤਾ ਅਤੇ ਆਰਾਮਦਾਇਕ ਵੀ ਹੁੰਦਾ ਰੇਲ ਗੱਡੀ ਜੋ ਕਿ ਰੇਲਵੇ ਲਾਈਨ 'ਤੇ ਚਲਦੀ ਹੈ ਕੋਈ ਟ੍ਰੇਨ ਬਿਜਲੀ 'ਤੇ ਵੀ ਚਲਦੀ ਹੈ ਅਤੇ ਇੱਕ ਮਾਲ ਗੱਡੀ ਹੁੰਦੀ ਹੈ ਜੋ ਸਮਾਨ ਨੂੰ ਇੱਧਰ ਉੱਧਰ ਲਿਜਾਂਦੀ ਹੈ ਰੇਲ ਗੱਡੀ ਵਿੱਚ ਸੀਟਾਂ ਵਰਤ ਆਦਿ ਬਹੁਤ ਆਰਾਮਦਾਇਕ ਹੁੰਦੇ ਆ ਜ਼ਿਆਦਾ ਲੰਬਾ ਸਫਰ ਕਰਨ ਲਈ ਵਰਤ ਦੀ ਵ ਵਰਤੋਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ 'ਤੇ ਆਰਾਮ ਨਾਲ ਸੁੱਤਾ ਵੀ ਜਾਂਦਾ ਹੈ ਇਸ ਨੂੰ ਇੰਜਣ ਚਲਾਉਂਦਾ ਹੈ ਜਿਸ ਦੇ ਪਹੀਏ ਸਟੀਲ ਦੇ ਬਣੇ ਹੁੰਦੇ ਆ ਜੋ ਕਿ ਰੇਲਵੇ ਲਾਈਨ 'ਤੇ ਦੌੜਦੇ ਆ ਮੈਂ ਵੀ ਇੱਕ ਵਾਰ ਰੇਲ ਗੱਡੀ 'ਤੇ ਸਫਰ ਕੀਤਾ ਸੀ ਜਦੋਂ ਮੈਂ ਅੰਮ੍ਰਿਤਸਰ ਤੋਂ ਦਿੱਲੀ ਗਿਆ ਮੇਰਾ ਇਹ ਅਨੁਭਵ ਬੜਾ ਵਧੀਆ ਸੀ ਜਦੋਂ ਥੋੜ੍ਹਾ ਥੱਕ ਜਾਵੇ ਤਾਂ ਥੋੜ੍ਹਾ ਤੁਰੋ ਫਿਰੋ ਫਿਰ ਫਿਰ ਬੈਠ ਜਾਓ ਸਫਰ ਬਹੁਤ ਆਰਾਮਦਾਇਕ ਰਹਿੰਦਾ ਹੈ